ਹੈਲੋ ਹਾਂਜੀ ਅੱਛਾ ਜੀ ਹਾਂਜੀ ਜ਼ਰੂਰ ਅੱਛਾ ਜੀ ਇਹ ਨਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਮੁਗਲਾਂ ਨਾਲ ਯੁੱਧ ਹੋਇਆ ਸੀਗਾ ਅਤੇ ਗੁਰੂ ਗੋਬਿੰਦ ਸਿੰਘ ਜੀ ਨਾ ਕੋਟਪੂਰਾ ਤੋਂ ਹੁੰਦੇ ਹੋਏ ਮੁਕਤਸਰ ਮੁਕਤਸਰ ਦਾ ਪਹਿਲਾਂ ਨਾਮ ਖਿਦਰਾਣੇ ਦੀ ਢਾਬ ਸੀਗਾ ਇੱਥੇ ਰੁਕੇ ਸੀ ਇੱਥੇ ਆਪਣੇ ਬਹੁਤ ਸਾਰੇ ਇਤਿਹਾਸਿਕ ਗੁਰਦੁਆਰੇ ਆ ਗੁਰੂ ਗੋਬਿੰਦ ਸਿੰਘ ਜੀ ਨਾਲ ਰਿਲੇਟਿਡ ਇੱਕ ਤਾਂ ਹੈਗਾ ਟਿੱਬੀ ਸਾਹਿਬ ਗੁਰਦੁਆਰਾ ਖੂਹ ਸਾਹਿਬ ਗੁਰਦੁਆਰਾ ਦਾਤਣ ਸਾਹਿਬ ਗੁਰਦੁਆਰਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾਤਣ ਕਰੀ ਜਾਂਦੇ ਸੀ ਅਤੇ ਮੁਗਲ ਨੇ ਆ ਕੇ ਪਿੱਛੋਂ ਵਾਰ ਕਰਿਆ ਸੀਗਾ ਅਤੇ ਗੁਰੂ ਸਾਹਿਬ ਨੇ ਦਾਤਣ ਕਰਦੇ ਉਹਨਾਂ ਦੇ ਗੜਵਾ ਮਾਰਿਆ ਸੀ ਅਤੇ ਗੜਵੇ ਨਾਲ ਹੀ ਉਹਨੂੰ ਸ਼ਹੀਦ ਕਰਤਾ ਸੀਗਾ ਉਹ ਮੁਸਲਮਾਨ ਦੀ ਨਾ ਕਬਰ ਬਣੀ ਹੋਈ ਉੱਥੇ ਦਾਤਣਸਰ ਗੁਰਦੁਆਰੇ ਦੇ ਬਾਹਰ ਜਦੋਂ ਆਪਣੇ ਇੱਥੇ ਮੁਕਤਸਰ ਮਾਘੀ ਮੇਲਾ ਲੱਗਦਾ ਉਦੋਂ ਉੱਥੇ ਸਾਰੇ ਸਿੱਖ ਛਿੱਤਰ ਮਾਰ ਕੇ ਆਉਂਦੇ ਫੇਰ ਉਹਨਾਂ ਦੀ ਯਾਤਰਾ ਸਫ਼ਲ ਹੁੰਦੀ ਆ ਅਤੇ ਇਹ ਕਿੱਥੇ ਆਪਣੇ ਹੈਗਾ ਟੁੱਟੀ ਗੰਢੀ ਸਾਹਿਬ ਗੁਰਦੁਆਰਾ ਜਿੱਥੇ ਭਾਈ ਮਹਾਂ ਸਿੰਘ ਨੇ ਵਿਦਾਵਾ ਪੜਵਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਅਤੇ ਜਿਹੜੇ ਚਾਲੀ ਸਿੰਘ ਅਨੰਦਪੁਰ ਸਾਹਿਬ ਦੀ ਲੜਾਈ ਵਿੱਚ ਛੱਡ ਕੇ ਚਲੇ ਗਏ ਸੀ ਨਾ ਗੁਰੂ ਸਾਹਿਬ ਨੂੰ ਉਹਨਾਂ ਨੇ ਖਿਦਰਾਣੇ ਦੀ ਢਾਬ ਆ ਕੇ ਵੀ ਗੁਰ ਲੜਾਈ ਲੜੀ ਸੀਗੀ ਅਤੇ ਸ਼ਹੀਦੀ ਪ੍ਰਾਪਤ ਕਰੀ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਨੂੰ ਆਪਦੀ ਗੋਦੀ 'ਚ ਪਾ ਕੇ ਚਾਲੀ ਮੁਕਤਿਆਂ ਨੂੰ ਮੁਕਤੀ ਦਿੱਤੀ ਸੀ ਅਤੇ ਵਿਦਾਵਾ ਪਾੜਿਆ ਸੀ ਉਹਦੇ ਸਾਹਮਣੇ ਈ ਗੁਰਦੁਆਰਾ ਅੰਗੀਠਾ ਸਾਹਿਬ ਆ ਜਿੱਥੇ ਉਹਨਾਂ ਚਾਲੀ ਸਿੰਘਾਂ ਦਾ ਸੰਸਕਾਰ ਕਰਿਆ ਗਿਆ ਸੀਗਾ ਇੱਕ ਆਪਣੇ ਹੈਗਾ ਗੁਰਦੁਆਰਾ ਤਰਨਤਾਰਨ ਸਾਹਿਬ ਜਿੱਥੇ ਗੁਰੂ ਸਾਹਿਬ ਨੇ ਵਰ ਦਿੱਤਾ ਸੀਗਾ ਬਈ ਇੱਥੇ ਕੋਈ ਵੀ ਚਮੜੀ ਰੋਗੀ ਆਊਗਾ ਇੱਥੇ ਹਰੇਕ ਐਤਵਾਰ ਪੰਜ ਇਸ਼ਨਾਨ ਕਰਕੇ ਲੂਣ ਅਤੇ ਬੁੱਕਾ ਚੜ੍ਹਾਵੇਗਾ ਤਾਂ ਉਹਨੂੰ ਚਮੜੀ ਦਾ ਕੋਈ ਵੀ ਰੋਗ ਆ ਉਹ ਦੂਰ ਹੋਉਗਾ ਹਾਂਜੀ ਅਤੇ ਇੱਕ ਆਪਣੇ ਹੈਗਾ ਖੂਹ ਸਾਹਿਬ ਗੁਰਦੁਆਰਾ ਉੱਥੇ ਗੁਰੂ ਜੀ ਨੇ ਤੀਰ ਮਾਰ ਕੇ ਪਾਣੀ ਕੱਢਿਆ ਸੀਗਾ ਹਾਂਜੀ ਹਾਂਜੀ ਇੱਕ ਰਕਾਬ ਰਕਾਬਗੰਜ ਗੁਰਦੁਆਰਾ ਆਪਣੇ ਉੱਥੇ ਗੁਰੂ ਸਾਹਿਬ ਦੇ ਘੋੜੇ ਦੀ ਰਕਾਬ ਟੁੱਟੀ ਸੀ ਉਹ ਰਕਾਬ ਅੱਜ ਵੀ ਉੱਥੇ ਸੁਸ਼ੋਭਿਤ ਆ ਗੁਰਦੁਆਰੇ ਦੇ ਅੰਦਰ ਹਾਂਜੀ ਗੁਰੂ ਸਾਹਿਬ ਨੇ ਮੁਕਤਸਰ ਖਿਦਾਰਣੇ ਦੀ ਢਾਬ ਨੂੰ ਬਹੁਤ ਸਾਰੇ ਵਰ ਦਿੱਤੇ ਆ ਇੱਥੇ ਲੰਘਦੇ ਹੋਏ ਗਏ ਆ ਗੁਰੂ ਸਾਹਿਬ ਹਾਂਜੀ ਹੋਰ ਜਾਣਕਾਰੀ ਮੇਨ ਆਪਣੇ ਉਹ ਆਹੀ ਆ ਬਸ ਵੀ ਇੱਥੇ ਚਾਲੀ ਮੁਕਤਿਆਂ ਨੂੰ ਮੁਕਤੀ ਮਿਲੀ ਸੀ ਉਹਦੇ ਤੋਂ ਆਪਣੇ ਸ਼ਹਿਰ ਖਿਦਰਾਣੇ ਦੀ ਢਾਬ ਦਾ ਨਾਮ ਸ਼੍ਰੀ ਮੁਕਤਸਰ ਸਾਹਿਬ ਪੈ ਗਿਆ ਸੀ ਇੱਕ ਇਤਿਹਾਸਿਕ ਜਗ੍ਹਾ ਬਣ ਗਿਆ ਇਹ ਵੀ ਚਾਲੀ ਚਾਲੀ ਸਿੰਘਾਂ ਨੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਲੜਾਈ ਲੜਦੇ ਹੋਏ ਸ਼ਹੀਦੀ ਪ੍ਰਾਪਤ ਕਰੀ ਅਤੇ ਗੁਰੂ ਸਾਹਿਬ ਨੇ ਉਹਨਾਂ ਦਾ ਵਿਦਾਵਾ ਪਾੜ ਕੇ ਉਹਨਾਂ ਨੂੰ ਮਾਫ਼ੀ ਦਿੱਤੀ ਅਤੇ ਮੁਕਤ ਕੀਤਾ ਜਨਮ ਮਰਨ ਦੇ ਚੱਕਰਾਂ ਤੋਂ ਹਾਂਜੀ ਠੀਕ ਹੈ ਜੀ